ਚਿੱਤਰਕਾਰੀ ਕਰਨ ਲਈ ਸਭ ਤੋਂ ਪਹਿਲਾਂ ਸਿੱਧੀਆਂ ਲਾਈਨਾਂ ਲਗਾਉਣ ਦੀ ਜਾਂਚ ਸਿੱਖਣੀ ਚਾਹੀਦੀ ਹੈ ਜਦੋਂ ਬੰਦੇ ਨੂੰ ਸਿੱਧੀਆਂ ਲਾਈਨਾਂ ਫ੍ਰੀ ਹੈਂਡ ਲਗਾਣੀਆਂ ਆ ਗਈਆਂ ਤਾਂ ਉਹ ਆਸਾਨੀ ਦੇ ਨਾਲ ਕੋਈ ਵੀ ਚਿੱਤਰ ਜਾਂ ਡਿਜ਼ਈਨ ਬਣਾ ਸਕਦਾ ਹੈ ਡਿਜ਼ਾਈਨ ਬਣਾਉਣ ਤੋਂ ਪਹਿਲੇ ਉਸਨੂੰ ਉਸ ਡਿਜ਼ਾਈਨ 'ਤੇ ਫੋਕਸ ਕਰਨਾ ਚਾਹੀਦਾ ਹੈ ਕਿ ਉਹ ਡਿਜ਼ਾਈਨ ਕਿਸ ਤਰ੍ਹਾਂ ਦਾ ਹੈ ਅਤੇ ਉਸ ਵਿੱਚ ਕਿਸ ਤਰ੍ਹਾਂ ਦੇ ਕਲਰ ਯੂਜ਼ ਹੁੰਦੇ ਹਨ ਔਰ ਕਲਰ ਉਸ ਨੂੰ ਕਲਰ ਕੰਬੀਨੇਸ਼ਨ ਵਧੀਆ ਯੂਜ਼ ਕ ਵਧੀਆ ਕਰਨੀ ਚਾਹੀਦੀ ਹੈ ਔਰ ਉਹ ਕਿੱਦਾਂ ਦੀ ਕਲਰ ਕੰਬੀਨੇਸ਼ਨ ਕਰਦਾ ਹੈ ਉਸ ਚਿੱਤਰ 'ਤੇ ਡਿਪੈਂਡ ਕਰਦਾ ਹੈ ਹਮੇਸ਼ਾ ਸਾਨੂੰ ਕੋਈ ਵੀ ਕਲਰ ਬਣਾਉਣ ਲੱਗਿਆ ਪਹਿਲਾਂ ਲਾਈਟ ਕਲਰ ਚੂਜ਼ ਕਰਨਾ ਚਾਹੀਦਾ ਹੈ ਫਿਰ ਉਸ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਡਾਰਕ ਕਲਰ ਮਿਕਸ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਕਲਰ ਵਧੀਆ ਅਤੇ ਚੰਗੇ ਢੰਗ ਨਾਲ ਬਣਦਾ ਹੈ ਚਿੱਤਰਕਾਰੀ ਵਿੱਚ ਹਮੇਸ਼ਾ ਕਲਰ ਕੰਬੀਨੇਸ਼ਨ ਹੀ ਮੈਟਰ ਕਰਦੀ ਹੈਗੀ ਅਸੀਂ ਕਿਸ ਤਰਾਂ ਦੇ ਅ ਚਿੱਤਰ ਹੈ ਅਤੇ ਉਸ 'ਤੇ ਕਿੱਦਾਂ ਦੇ ਕਲਰ ਯੂਜ਼ ਕੀਤੇ ਹਨ